ਬੱਚੇ ਦੇ ਜਨਮ ਤੋਂ ਹੀ ਰਸਮ ਰਿਵਾਜ਼ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਕੀਤੀ ਜਾਣ ਵਾਲੀ ਸਭ ਤੋਂ ਪਹਿਲੀ ਰਸਮ ਜਿਹੜੀ ਹੈ ਉਸ ਰਸਮ ਨੂੰ ਗੁੜਤੀ ਦੀ ਰਸਮ ਕਿਹਾ ਜਾਂਦਾ ਹੈ ਗੁੜਤੀ ਤੋਂ ਭਾਵ ਕਿ ਕੋਈ ਵੀ ਮਿੱਠੀ ਚੀਜ਼ ਜਿਹੜੀ ਹੈ ਸਭ ਤੋਂ ਪਹਿਲਾਂ ਨਵਜਨਮੇ ਬੱਚੇ ਦੇ ਮੂੰਹ ਦੇ ਵਿੱਚ ਪਾਈ ਜਾਂਦੀ ਹੈ ਉਹ ਸ਼ਹਿਦ ਵੀ ਹੋ ਸਕਦੀ ਹੈ ਮਿਸ਼ਰੀ ਜਾਂ ਗੁੜ ਦੀ ਡਲੀ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਜਣੇਪੇ ਦੀ ਰਸਮ ਕੀਤੀ ਜਾਂਦੀ ਹੈ ਬੱਚੇ ਦੇ ਨਾਨਕੇ ਜਿਹੜੇ ਹੁੰਦੇ ਨੇ ਉਹ ਵਧਾਈ ਦੇ ਤੌਰ ਦੇ ਉੱਪਰ ਮਠਿਆਈ ਜਾਂ ਕੋਈ ਵੀ ਵਸਤਾਂ ਜਿਹੜੀਆਂ ਨੇ ਉਹ ਨਵਜੰਮੇ ਬੱਚੇ ਜਾਂ ਮਾਂ ਲਈ ਲੈ ਕੇ ਆਉਂਦੇ ਨੇ ਉਸਨੂੰ ਜਣੇਪੇ ਦੀ ਰਸਮ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਪੰਜਵਾਂ ਨਹਾਉਣ ਦੀ ਰਸਮ ਜਿਹੜੀ ਹੈ ਉਹ ਹੁੰਦੀ ਹੈ ਦਾਈ ਵੱਲੋਂ ਜਿਹੜਾ ਹੈਗਾ ਹੈ ਉਹ ਮਾਂ ਅਤੇ ਬੱਚੇ ਨੂੰ ਪੰਜਵੇਂ ਦਿਨ ਨਵਾਇਆ ਜਾਂਦਾ ਹੈ ਅਤੇ ਉਸ ਰਸਮ ਨੂੰ ਪੰਜਵਾਂ ਨਵਾਉਣਾ ਜਿਹੜਾ ਹੈ ਉਹ ਕਹਿੰਦੇ ਨੇ ਵੈਸੇ ਸਿੱਖ ਧਰਮ ਦੇ ਵਿੱਚ ਕਿਸੇ ਤਰੀਕੇ ਦਾ ਵੀ ਨਾਮ ਸੰਸਕਾਰ ਨਹੀਂ ਹੈਗਾ ਕਿਸੇ ਵੇਲੇ ਕ ਘਰ ਦੇ ਜੀ ਹੀ ਮਿਲ ਕੇ ਜਿਹੜੇ ਨੇ ਉਹ ਬੱਚੇ ਦਾ ਨਾਮ ਰੱਖ ਲੈਂਦੇ ਨੇ ਜਾਂ ਕਈਆਂ ਨੇ ਪਹਿਲਾਂ ਤੋਂ ਹੀ ਜਿਵੇਂ ਸੋਚਿਆ ਹੁੰਦਾ ਹੈ ਕਿ ਹਾਂਜੀ ਅਸੀਂ ਆਪਣੇ ਬੱਚੇ ਦਾ ਨਾਮ ਕੀ ਰੱਖਣਾ ਹੈ ਪਰ ਕਿਸੇ ਵੇਲੇ ਕੀ ਹੁੰਦਾ ਕਿ ਕਿਸੇ ਵੀ ਧਰਮ ਗ੍ਰੰਥ ਦਾ ਕੋਈ ਪੰਨਾ ਖੁੱਲਵਾ ਕੇ ਉਸ ਪੰਨੇ ਦੇ ਪਹਿਲੇ ਅੱਖਰ 'ਤੇ ਜਿਹੜਾ ਵੀ ਅੱਖਰ ਹੁੰਦਾ ਹੈ ਉਸ ਤੋਂ ਨਾਮ ਜਿਹੜਾ ਹੈ ਬੱਚੇ ਦਾ ਉਹ ਰੱਖਿਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਫਿਰ ਘਰ ਦੇ ਵਿੱਚ ਵਧਾਈ ਦੇ ਲਈ ਬਾਬੇ ਵੀ ਆਉਂਦੇ ਨੇ ਜਿਹੜੇ ਕਿ ਘਰ ਦੇ ਕਿ ਆਪਣੇ ਦ ਉਹਨਾਂ ਦਾ ਜਿਹੜਾ ਕਮਰਾ ਹੁੰਦਾ ਹੈ ਉਹਦੇ ਬਾਹਰ ਸਜਾਵਟ ਕਰਦੇ ਨੇ ਫਿਰ ਬੱਚੇ ਦੀ ਪਹਿਲਾ ਤਿਉਹਾਰ ਜਿਹੜਾ ਵੀ ਹੁੰਦਾ ਹੈ ਚਾਹੇ ਉਹ ਦਿਵਾਲੀ ਹੋਵੇ ਉਸ ਨੂੰ ਵੀ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਆਲੇ ਦੁਆਲੇ ਦੇ ਵਿੱਚ ਵਧਾਈ ਦੇ ਤੌਰ 'ਤੇ ਜਾਂ ਖੁਸ਼ੀ ਦੇ ਤੌਰ 'ਤੇ ਕਹਿ ਲਓ ਮਠਿਆਈ ਵੰਡੀ ਜਾਂਦੀ ਹੈ ਬੱਚੇ ਦੇ ਜਨਮ ਦੇ ਵਿੱਚ ਜਿਹੜਾ ਪਹਿਲੀ ਸਭ ਤੋਂ ਪਹਿਲੀ ਲੋਹੜੀ ਹੁੰਦੀ ਹੈ ਉਸਨੂੰ ਵੀ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਉਸ ਘਰ ਦੇ ਵਿੱਚ ਕੁੜੀਆਂ ਬੱਚੇ ਤਿਆਰ ਹੋ ਕੇ ਆਉਂਦੇ ਨੇ ਲੋਹੜੀ ਵਾਲੇ ਦਿਨ ਲੋਹੜੀ ਮੰਗਦੇ ਨੇ ਫਿਰ ਘਰ ਦੇ ਜੀਅ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਿਸੇ ਵੇਲੇ ਪੈਸਿਆਂ ਦੇ ਨਾਲ ਸ਼ਗਨ ਦਿੰਦੇ ਜੇ ਨਹੀਂ ਤਾਂ ਫਿਰ ਉਹਨਾਂ ਨੂੰ ਰਿਓੜੀਆਂ ਫੁੱਲੇ ਮੂੰਗਫਲੀਆਂ ਇਹਨਾਂ ਸਭ ਦਾ ਵੀ ਜਿਹੜਾ ਹੈ ਉਹ ਲੋਹੜੀ ਵਾਲੇ ਦਿਨ ਉਹਨਾਂ ਨੂੰ ਦਿੰਦੇ ਆ